ਮੈਨੂੰ ਬਾਈਕਿੰਗ ਸ਼ੁਰੂ ਕਰਨ ਲਈ ਆਪਣੇ ਆਪ ਤੋਂ ਪ੍ਰੇਰਿਤ ਹੋਣਾ ਪਿਆ ਕਿਉਂਕਿ ਜਦੋਂ ਮੈਂ ਸਕੂਲ ਜਾਣਾ ਹੁੰਦਾ ਟਿਊਸ਼ਨ ਜਾਣਾ ਹੁੰਦਾ ਜਾਂ ਕਾਲਜ ਜਾਣਾ ਹੁੰਦਾ ਤਾਂ ਮੈਂ ਲੇਟ ਹੋ ਜਾਂਦੀ ਸੀ ਕਿਉਂਕਿ ਮੈਨੂੰ ਕਈ ਵਾਰ ਪੈਦਲ ਜਾਣਾ ਪੈਂਦਾ ਸੀ ਕਈ ਵਾਰ ਆਟੋ ਵੇਖਣਾ ਪੈਂਦਾ ਸੀ ਤੇ ਕਾਫੀ ਕਾਫੀ ਟਾਈਮ ਆਟੋ ਨਹੀਂ ਮਿਲਦੇ ਸੀ ਜਿਸ ਕਰਕੇ ਮੈਂ ਬਹੁਤ ਜਿਆਦੇ ਲੇਟ ਹੋ ਜਾਂਦੀ ਸੀ ਟਾਈਮ ਸਿਰ ਨਹੀਂ ਪਹੁੰਚਦੀ ਸੀ ਲੈਕਚਰ ਵਗੈਰਾ ਮਿਸ ਹੁੰਦੇ ਸੀ ਇਸ ਕਰਕੇ ਮੈਨੂੰ ਆਪਦੇ ਆਪ ਨੂੰ ਹੀ ਆਪਣੇ ਆਪ ਖੁਦ ਨੂੰ ਪ੍ਰੇਰਿਤ ਹੋਣਾ ਪਿਆ ਕਿ ਮੈਨੂੰ ਬਾਈਕ ਸਿੱਖਣੀ ਚਾਹੀਦੀ ਆ ਕਿਉਂਕਿ ਬਾਈਕ ਦਾ ਇਹ ਬੈਨੀਫਿਟ ਐ ਕਿ ਜੇ ਆਪਾਂ ਨੂੰ ਬਾਈਕ ਆਉਂਦੀ ਆ ਤਾਂ ਆਪਾਂ ਕਿਤੇ ਵੀ ਆਪਦੇ ਕੰਮ ਕਾਰ ਲਈ ਟਾਈਮ ਸਿਰ ਤੇ ਪਹੁੰਚ ਸਕਦੇ ਆਂ ਕਿਉਂਕਿ ਟਾਈਮ ਸਿਰ ਤੇ ਜਾਣਾ ਹੀ ਆਪਣਾ ਇੱਕ ਰੂਲ ਐ ਕਿਉਂਕਿ ਅੱਜ ਕੱਲ ਤਾਂ ਸਕੂਲਾਂ ਕਾਲਜਾਂ ਵਿੱਚ ਇੱਕ ਪ੍ਰੋਪਰ ਟਾਈਮ ਹੁੰਦਾ ਕੀ ਤੁਸੀਂ ਇਸ ਟਾਈਮ ਤੇ ਪਹੁੰਚਣਾ ਈ ਪਹੁੰਚਣਾ ਜਿਸ ਕਰਕੇ ਆਪਾਂ ਨੂੰ ਆਪਣੀ ਅਟੈਂਡਸ ਵੀ ਸ਼ੋਟ ਹੋ ਜਾਂਦੀ ਆਪਾਂ ਸਹੀ ਟਾਈਮ ਤੇ ਨਹੀਂ ਪਹੁੰਚਦੇ ਤਾਂ ਇਹ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਇਸੇ ਲਈ ਬਾਈਕ ਸਿੱਖਣੀ ਤਾਂ ਮੇਰੇ ਲਈ ਜਰੂਰੀ ਹੋ ਗਈ ਸੀ ਕਿਉਂਕਿ ਫਿਰ ਮੈਨੂੰ ਜਾਣਾ ਕਰਨਾ ਬਹੁਤ ਏ ਸੌਖਾ ਹੋ ਗਿਆ ਸੀ ਜਦੋਂ ਮੈਂ ਬਾਈਕ ਸਿੱਖ ਚੁੱਕੀ ਸੀ ਤੇ ਹੋਰ ਘਰ ਦੇ ਕੰਮਾਂ ਲਈ ਵੀ ਬਾਈਕ ਤੇ ਜਾਂ ਬਾਹਰ ਜਾਣਾ ਪੈਂਦਾ ਸੀ ਜਿਸ ਕਰਕੇ ਮੈਨੂੰ ਸਾਡੇ ਘਰ ਵਿੱਚ ਹੋਰ ਬਹੁਤ ਘੱਟ ਬਾਈਕ ਸਿੱਖਣ ਵਾਲੇ ਸੀ ਮੇਰਾ ਭਰਾ ਛੋਟਾ ਸੀ ਇਸ ਲਈ ਉਹਨੇ ਬਾਈਕ ਨਹੀਂ ਸਿੱਖੀ ਉਹਤੋਂ ਪਹਿਲਾਂ ਮੈਂ ਬਾਈਕ ਸਿੱਖੀ ਤਾਂ ਜੋ ਕਿ ਸਾਨੂੰ ਆਉਣ ਕਿਤੇ ਵੀ ਆਣ ਜਾਣ ਦੇ ਵਿੱਚ ਮੁਸ਼ਕਿਲ ਨਾ ਹੋਵੇ ਤੇ ਫਿਰ ਮੈਂ ਜਦੋਂ ਬਾਈਕ ਸਿੱਖੀ ਤਾਂ ਮੈਨੂੰ ਮੁਸ਼ਕਿਲਾਂ ਆਈਆਂ ਕਈ ਬਹੁਤ ਜਿਆਦੇ ਮੁਸ਼ਕਿਲਾਂ ਆਈਆਂ ਮੈਨੂੰ ਬਾਈਕ ਬਾਰੇ ਨੋਲੇਜ ਨਹੀਂ ਸੀਗੀ ਫਿਰ ਹੌਲੀ ਹੌਲੀ ਕਰਕੇ ਜਦੋਂ ਮੈਨੂੰ ਬਾਈਕ ਵਾਰੇ ਨੌਲੇਜ ਹੋਊਗੀ ਮੈਂ ਹੌਲੀ ਹੌਲੀ ਚਲਾਉਣੀ ਸ਼ੁਰੂ ਕੀਤੀ ਪਹਿਲਾ ਖੁੱਲੇ ਥਾਂ ਵਿੱਚ ਫਿਰ ਉਤੋਂ ਬਾਅਦ ਟਰੈਫਿਕ ਦੇ ਵਿੱਚ ਚਲਾਉਣੀ ਸ਼ੁਰੂ ਕੀਤੀ ਤਾਂ ਮੇਰਾ ਹੋਲੀ ਹੋਲੀ ਡਰ ਖੁਲਿਆ ਤੇ ਇਹ ਡਰ ਖੁੱਲਨ ਕਰਕੇ ਹੀ ਮੈਂ ਬਾਅਦ ਵਿੱਚ ਮਾਰਕੀਟ ਦੇ ਵਿੱਚ ਲੈ ਕੇ ਜਾਣੀ ਸ਼ੁਰੂ ਕੀਤੀ ਹੌਲੀ ਹੌਲੀ ਕਰਕੇ ਕਾਲਜ ਦੇ ਵਿੱਚ ਲਿਜਾਣੀ ਸ਼ੁਰੂ ਕੀਤੀ ਬਾਈਕ ਤਾਂ ਮੈਨੂੰ ਇਦਾਂ ਲੱਗਿਆ ਕਿ ਮੈਂ ਹੁਣ ਚਲਾ ਸਕਦੀ ਆ ਤੇ ਉਹਤੋਂ ਬਾਅਦ ਹੌਲੀ ਹੌਲੀ ਕਰਕੇ ਹਰ ਇੱਕ ਸਾਲ ਮੇਰਾ ਐਕਸਪੀਰੀਅੰਸ ਹੁੰਦਾ ਗਿਆ ਤੇ ਮੈਂ ਮਤਲਬ ਬਹੁਤ ਵਧੀਆ ਬਾਈਕ ਡਰਾਈਵ ਕਰ ਸਕਦੀ ਆਂ ਤੇ ਹੁਣ ਵੀ ਮੈਂ ਬਹੁਤ ਵਧੀਆ ਬਾਈਕ ਡਰਾਈਵ ਕਰ ਲੈਨੀ ਆ ਤੇ ਜਿਸ ਕਰਕੇ ਮੈਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਮੈਂ ਵਧੀਆ ਤਰੀਕੇ ਨਾਲ ਆਪਦਾ ਜਿੱਥੇ ਵੀ ਜਾ ਸਕਦੀ ਆਂ ਇਹੀ ਨਹੀਂ ਕਿ ਮੈਂ ਮਾਰਕੀਟ ਤੱਕ ਹੀ ਸੀਮਤ ਆ ਬਾਈਕ ਤੇ ਮੈਂ ਹੋਰ ਵੀ ਬਹੁਤ ਮਤਲਬ ਨੇੜੇ ਤੇੜੇ ਜਿੱਦਾਂ ਕੀ ਘਰ ਤੋਂ ਦਸ ਬਾਰਾਂ ਕਿਲੋਮੀਟਰ ਤੱਕ ਵੀ ਮੈਂ ਬਾਈਕ ਤੇ ਆਰਾਮ ਨਾਲ ਸਫਰ ਤੈਅ ਕਰ ਸਕਦੀ ਆਂ